ਮੈਨੂੰ ਬਾਗਬਾਨੀ ਦਾ ਜਨਮ ਤੋਂ ਹੀ ਸ਼ੌਂਕ ਆ ਅਤੇ ਸਾਡੇ ਬਜ਼ੁਰਗਾਂ ਨੇ ਵੀ ਬਾਗ ਲਾਏ ਹੋਏ ਹਨ ਸੰਤਰੇ ਵਗੈਰਾ ਦੇ ਅਤੇ ਬਾਗਬਾਨੀ ਜਿਹੜੇ ਲਾਉਣ ਦਾ ਸਾਨੂੰ ਬਹੁਤ ਫਾਇਦਾ ਹੋਇਆ ਇੱਕ ਤਾਂ ਅਸੀਂ ਸਪਰੇਆਂ ਰਾਹੀਂ ਫਰੂਟ ਵਗੈਰਾ ਖਾਣੇ ਤੋਂ ਬਚੇ ਹੋਏ ਹਨ ਅਤੇ ਬਿਮਾਰੀਆਂ ਤੋਂ ਬਚੇ ਹਨ ਅਤੇ ਇਸ ਵਿੱਚ ਸਾਨੂੰ ਪੈਸਾ ਵੀ ਬਣਦਾ ਵੇਚਣ 'ਤੇ ਅਤੇ ਬਾਗਬਾਨੀ ਨਾਲ ਸਾਡਾ ਬਹੁਤ ਵਾਧਾ ਹੋਇਆ ਅਤੇ ਅੱਗੇ ਨੂੰ ਵੀ ਸਾਡੇ ਬੱਚੇ ਵੀ ਜਿਹੜੇ ਆ ਸਾਡੀ ਰੀਸ ਨਾਲ ਸਾਡੇ ਬੂਟਿਆਂ ਦੀ ਸੇਵਾ ਚੰਗੀ ਕਰਦੇ ਆ ਅਤੇ ਉਹਨਾਂ ਨੂੰ ਵੀ ਸ਼ੌਂਕ ਪੂਰਾ ਸਾਡੇ ਮੰਗਣਾ ਹੀ